ਸਤਿ ਸ਼੍ਰੀ ਅਕਾਲ ਜੀ ਕੱਕੜ ਬੁੱਕ ਹਾਊਸ ਰੋਪੜ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਕੋਲੋਂ ਕੁਛ ਦਿਨ ਪਹਿਲਾਂ ਕਿਤਾਬਾਂ ਮੰਗਵਾਈਆਂ ਸਨ ਉਹਨਾਂ ਨੂੰ ਦੇਖ ਕਿ ਮੈਨੂੰ ਇਹ ਕਾਫੀ ਦੁੱਖ ਹੋਇਆ ਕਿ ਉਹਨਾਂ ਦੀ ਛਪਾਈ ਦੇ ਵਿੱਚੋਂ ਪੇਜ਼ ਕਾਫੀ ਫਟੇ ਹੋਏ ਸਨ ਬੱਚਿਆਂ ਦੇ ਪੱਧਰ ਦੇ ਲੈਵਲ ਨਾਲ ਮੇਲ ਨਹੀਂ ਖਾਂਦੇ ਸੀਗੇ ਇਸ ਕਰਕੇ ਮੈਨੂੰ ਆਸ ਹੈ ਕਿ ਮੈਂ ਅੱਗੇ ਤੋਂ ਇਹੋ ਜਿਹੀਆਂ ਕਿਤਾਬਾਂ ਨਾ ਮੰਗਾਵਾਂ